ਸਾਡੇ ਖੇਤਰ ਦੇ ਵਿੱਚ ਤਕਨੀਕੀ ਪ੍ਰਣਾਲੀ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਸਾਰੇ ਲੋਕ ਪੜ੍ਹੇ ਲਿਖੇ ਨੇ ਅਤੇ ਇੱਥੋਂ ਦਾ ਜਿਹੜਾ ਨੈ ਨੈੱਟਵਰਕ ਦੀ ਗੱਲ ਕਰੀਏ ਜ਼ਿਆਦਾ ਬਹ ਏਅਰਟੈੱਲ ਜੀਓ ਜਾਂ ਕੋਈ ਹੋਰ ਹੈ ਇਹਨਾਂ ਦਾ ਨੈੱਟਫੁੱਟ ਬਹੁਤ ਜ਼ਿਆਦਾ ਵਧੀਆ ਹੈ ਅਤੇ ਵਧੀਆ ਰੇਂਜ ਹੈ ਇਹਨਾਂ ਦੀ ਅਤੇ ਇਹਨਾਂ ਦੇ ਡਾਟਾ ਪੈਕ ਵੀ ਜ਼ਿਆਦਾ ਵਧੀਆ ਨੇ ਠੀਕ ਹੈ ਅਤੇ ਲੋਕ ਸਾਰੇ ਹੈ ਜੋ ਅੱਜ ਕੱਲ੍ਹ ਐਜੂਕੇਟਿਡ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਵੱਡੇ ਮੁੱਦੇ ਦਾ ਸਾਹਮਣਾ ਕਰਨਾ ਪਊਂਗਾ